ਮੈਂ ਪੰਜਾਬ ਸਟੇਟ ਵਿੱਚ ਰਹਿੰਦੀ ਹਾਂ ਪੰਜਾਬ ਸਟੇਟ ਦੀ ਟਰਾਂਸਪੋਟ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ ਕਿਤੇ ਵੀ ਆਉਣ ਜਾਣ ਲਈ ਤੁਸੀਂ ਔਨਲਾਈਨ ਟੈਕਸੀ ਬੁੱਕ ਕਰਾ ਸਕਦੇ ਹੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਜਾਇਆ ਜਾ ਸਕਦਾ ਹੈ ਟੈਕਸੀ ਤੁਹਾਨੂੰ ਸਮੇਂ 'ਤੇ ਹੀ ਪਹੁੰਚਾ ਦਿੰਦੀ ਹੈ ਅਸੀਂ ਆਪਣੇ ਘਰ ਅੰਦਰ ਬੈਠ ਕੇ ਹੀ ਔਨਲਾਈਨ ਟੈਕਸੀ ਬੁੱਕ ਕਰ ਸਕਦੇ ਹਾਂ ਜੋ ਕਿ ਸਾਨੂੰ ਪੂਰੇ ਸਮੇਂ 'ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਦਿੰਦੀ ਹੈ ਇਸ ਦੇ ਨਾਲ ਸਮੇਂ ਦੇ ਵੀ ਬਹੁਤ ਬੱਚਤ ਹੋ ਜਾਂਦੀ ਹੈ ਭਾਰਤ ਭਰ ਵਿੱਚ ਯਾਤਰਾ ਕਰਦੇ ਹੋਏ ਅਸੀਂ ਕਈ ਹੋਰ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਵੀ ਕਰ ਸਕਦੇ ਹਾਂ ਜਿਵੇਂ ਕਿ ਈ ਰਿਕਸ਼ਾ ਬੱਸ ਸਕੂਟਰ ਅਤੇ ਹੋਰ ਰੇਲਵੇ ਵਰਗੀਆਂ ਸੇਵਾਵਾਂ ਦਾ ਵੀ ਜਿਵੇਂ ਕਿ ਜੇਕਰ ਅਸੀਂ ਕਿਤੇ ਨੇੜੇ ਹੀ ਜਾਣਾ ਹੋਵੇ ਤਾਂ ਸਾਨੂੰ ਈ ਰਿਕਸ਼ਾ ਟੈਕਸੀ ਸਕੂਟਰ ਆਦਿ ਵਰਗੀਆਂ ਸੇਵਾਵਾਂ ਦਾ ਆਨੰਦ ਮਾਣ ਸਕਦੇ ਹਾਂ ਜੇਕਰ ਸਾਡਾ ਸਫਰ ਲੰਬਾ ਹੋਵੇ ਤਾਂ ਅਸੀਂ ਰੇਲਵੇ ਬੱਸਾਂ ਅਤੇ ਮੈਟਰੋ ਵਰਗੀਆਂ ਸੇਵਾਵਾਂ ਦਾ ਆਨੰਦ ਮਾਣ ਸਕਦੇ ਹਾਂ ਮੈਟਰੋ ਇੱਕ ਸਭ ਤੋਂ ਤੇਜ਼ ਚੱਲਣ ਵਾਲੀ ਹੀ ਰੇਲਗਾਡੀ ਹੁੰਦੀ ਹੈ ਜਿਸ ਵਿੱਚ ਘੱਟ ਤੋਂ ਘੱਟ ਸਮੇਂ ਵਿੱਚ ਅਸੀਂ ਇੱਕ ਸਥਾਨ ਤੋਂ ਦੂਜੇ ਸਥਾਨ ਪਹੁੰਚ ਸਕਦੇ ਹਾਂ ਇਸ ਕਰਕੇ ਭਾਰਤ ਵਿੱਚ ਯਾਤਰਾ ਕਰਨਾ ਬਹੁਤ ਹੀ ਕਿਫਾਇਤੀ ਹੀ ਹੁੰਦਾ ਹੈ